ਭਾਰਤ 'ਚ ਡਾਂਸਰਾਂ ਅਤੇ ਬੋਲੀਵੁੱਡ ਦਾ ਬਹੁਤ ਹੀ ਵੱਡਾ ਪ੍ਰਭਾਵ ਹੈ ਹਰੇਕ ਦੂਜਾ ਬੰਦਾ ਆਪਣੇ ਮਨੋਰੰਜਨ ਲਈ ਬੋ ਬੋਲੀਵੁੱਡ ਵੇਖਦਾ ਹੈ ਕੋਈ ਬੋਲੀਵੁੱਡ ਫਿਲਮਾਂ ਵੇਖਦਾ ਹੈ ਅਤੇ ਕੋਈ ਬੋਲੀਵੁੱਡ ਨਾਟਕ ਵੇਖਦਾ ਹੈ ਅਤੇ ਡਾਂਸਰਾ ਦਾ ਵੀ ਬਹੁਤ ਵੱਡਾ ਮਹੱਤਵ ਹੈ ਲੋਕ ਆਪਣੇ ਆਪਣੇ ਆਪ ਨੂੰ ਮਨੋਰੰਜਨ ਕਰਨ ਲਈ ਡਾਂਸ ਵੇਖਦੇ ਹਨ ਅਤੇ ਉਹਨਾਂ ਤੋਂ ਗਾਣੇ ਸੁਣਦੇ ਹਨ ਲੋਕਾਂ ਨੂੰ ਆਪਦੇ ਆਪ ਆਪਦੇ ਆਪਦਾ ਮਨੋਰੰਜਨ ਅੱਜ ਕੱਲ੍ਹ ਕਰਨਾ ਬਹੁਤ ਹੀ ਔਖਾ ਲੱਗਦਾ ਹੈ ਇਸ ਲਈ ਉਹ ਜ਼ਿਆਦਾ ਤੋਂ ਜ਼ਿਆਦਾ ਬੋਲੀਵੁੱਡ ਉੱਤੇ ਇਹਨਾਂ ਡਾਂਸਾਂ ਦਾ ਹੀ ਸਹਾਰਾ ਲੈਂਦੇ ਹਨ ਲੋਕਾਂ ਨੂੰ ਜ਼ਿਆਦਾਤਰ ਅਰੀਜੀਤ ਸਿੰਘ ਦੇ ਗਾਣੇ ਵੀ ਪਸੰਦ ਆਉਂਦੇ ਹਨ ਕਿਉਂਕਿ ਉਹ ਹਰੇਕ ਕਿਸਮ ਦੇ ਗਾਣੇ ਗਾਉਂਦਾ ਹੈ ਜਿਵੇਂ ਕਿ ਰੋਮੈਂਟਿਕ ਅਤੇ ਸੈਡ ਕਈ ਲੋਕਾਂ ਨੂੰ ਸੈਡ ਗਾਣੇ ਪਸੰਦ ਆਉਂਦੇ ਹਨ ਅਤੇ ਕਈਆਂ ਨੂੰ ਰੋਮੈਂਟਿਕ ਲੋਕਾਂ ਦੀ ਆਪਦੀ ਪਸੰਦ ਹੈ ਪਰ ਮੈਨੂੰ ਲੱਗਦਾ ਜ਼ਿਆਦਾਤਰ ਲੋਕ ਅਰੀਜੀਤ ਸਿੰਘ ਨੂੰ ਸੁਣਨਾ ਪਸੰਦ ਕਰਦੇ ਹਨ ਕਿਉਂਕਿ ਉਹਦੀ ਆਵਾਜ਼ ਦੇ ਵਿੱਚ ਇੱਕ ਅਲੱਗ ਹੀ ਦਰਦ ਹੈ